ਤੇਈ ਜਨਵਰੀ ਉੱਨੀ ਸੌ ਨੜਿਨਵੇਂ ਚੌਵੀ ਜਨਵਰੀ ਦੋ ਹਜ਼ਾਰ ਪੰਜ ਚੌਵੀ ਜਨਵਰੀ ਦੋ ਹਜ਼ਾਰ ਸੱਤ ਛੱਬੀ ਜਨਵਰੀ ਦੋ ਹਜ਼ਾਰ ਅੱਠ ਪੱਚੀ ਜਨਵਰੀ ਦੋ ਹਜ਼ਾਰ ਨੌ